ਹੈਲੋ ਹਾਂਜੀ ਹਾਂਜੀ ਮਾਤਾ ਜੀ ਬਰਨਾਲਾ ਕਲੱਬ ਤੋਂ ਬੋਲਦੇ ਆ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬੱਚੇ ਫੋਨਾਂ ਵਿੱਚ ਬਹੁਤ ਧਿਆਨ ਦਿੰਦੇ ਹਨ ਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਕਿੱਥੋਂ ਬੋਲਦੇ ਹੋ ਜੀ ਹਾਂਜੀ ਹਾਂ ਸਾਡੇ ਕੋਲ ਹੰਢਾਇਆ ਤੋਂ ਬਹੁਤ ਬੱਚੇ ਆਉਂਦੇ ਨੇ ਜੀ ਹਾਂਜੀ ਆਪਣੇ ਕੋਲ ਬਹੁਤ ਖੇਡਾਂ ਨੇ ਦੇਖੋ ਜੀ ਜਿਵੇਂ ਹੁਣ ਕਰਾਟੇ ਹੋ ਗਏ ਜੀ ਸਵੀਮਿੰਗ ਹੋ ਗਈ ਜੀ ਹੋਰ ਬਾਸਕਿਟਬੋਲ ਹੋ ਗਈ ਫੁੱਟਬੋਲ ਹੋ ਗਈ ਜੀ ਡਾਂਸਿੰਗ ਹੋ ਗਿਆ ਜੀ ਹਾਂਜੀ ਕੁੜੀਆਂ ਲਈ ਆਪਾਂ ਕਰਾਟੇ ਸਿੱਖਵਾ ਦੇਵਾਂਗੇ ਜੀ ਅਤੇ ਬੱਚੇ ਨੂੰ ਕੋਈ ਫੁੱਟਬੋਲ ਜਾਂ ਬਾਸਕਿਟਬਾਲ ਹਾਂਜੀ ਇਸ ਤਰ੍ਹਾਂ ਦੀਆਂ ਗੇਮਾਂ ਬਹੁਤ ਨੇ ਜੀ ਆਪਣੇ ਕੋਲ ਹਾਂਜੀ ਹਾਂਜੀ ਹਾਂਜੀ ਦੋਵੇਂ ਖੇਡਾਂ ਆਪਣੇ ਕੋਲ ਅਵੇਲੇਬਲ ਨੇ ਜੀ ਆਪਾਂ ਕਰਵਾ ਦੇਵਾਂਗੇ ਜੀ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਜੀ ਤੁਸੀਂ ਆਪਣੇ ਕਲੱਬ 'ਚ ਆ ਜਿਓ ਜੀ ਇੱਕ ਵਾਰੀ ਤੁਹਾਨੂੰ ਡੈਮੋ ਦੇ ਦਾਂਗੇ ਜੀ ਤਾਂ ਤੁਸੀਂ ਦੇਖ ਲਿਓ ਕੋਈ ਨਾ ਬੈਠ ਕੇ ਆਪਾਂ ਗੱਲ ਕਰ ਲਾਂਗੇ ਫੀਸ ਬਾਰੇ ਤਾਂ ਜੀ ਹਾਂਜੀ ਟੈਮ ਆਪਣਾ ਦਸ ਤੋਂ ਪੰਜ ਵਜੇ ਤੱਕ ਦਾ ਹੁੰਦਾ ਜੀ ਪੰਜ ਤੋਂ ਬਾਅਦ ਲੈਣਾ ਜੀ ਹਾਂਜੀ ਫਿਰ ਕੋਈ ਗੱਲ ਨਹੀਂ ਆਪਾਂ ਪੰਜ ਤੋਂ ਛੇ ਕਰ ਦਾਂਗੇ ਜੀ ਇਹਦਾ ਟਾਇਮ ਘੰਟਾ ਹੋਰ ਲਾ ਲਿਆ ਕਰਾਂਗੇ ਜੀ ਹਾਂਜੀ ਹਾਂ ਹਾਂਜੀ ਹਾਂ ਕੋਈ ਨਾ ਵੈਨ ਆਉਂਦੀ ਹੈ ਜੀ ਆਪਣੀ ਘਰੋਂ ਲੈ ਜਿਆ ਕਰੂਗੀ ਜੀ ਕਲੱਬ ਪਿੱਛੇ ਆ ਜਾਂਦੀ ਹੈ ਹਾਂਜੀ ਹਾਂਜੀ ਹਾਂਜੀ ਹਾਂ

ਹਾਂਜੀ ਹਾਂ ਕੋਈ ਗੱਲ ਨਹੀਂ ਤੁਸੀਂ ਬਸ ਤੁਸੀਂ ਇਹਨਾਂ ਨੂੰ ਲੈ ਆਇਓ ਜੀ ਆਪਾਂ ਕੋਈ ਨਾ ਕਰਵਾ ਦਵਾਂਗੇ ਜੀ ਕੋਈ ਨਾ ਹਾਂਜੀ ਹਾਂਜੀ ਹਾਂਜੀ ਇਹ ਜ਼ਰੂਰੀ ਹੈ ਜੀ ਨਾਲੇ ਇਸ ਨਾਲ ਸਰੀਰ ਫਿੱਟ ਰਹਿੰਦਾ ਜੀ ਆਪਣਾ ਹਾਂਜੀ ਓਕੇ ਜੀ